ਅੱਜ ਕੱਲ੍ਹ ਦੇ ਬੱਚੇ ਗਰਾਊਂਡਾਂ ਵਿੱਚ ਜਾ ਕੇ ਸ਼ਾ ਸ਼ਾਰੀਰਿਕ ਗੇਮਾਂ ਨਹੀਂ ਖੇਲਦੇ ਹਨ ਜਿਵੇਂ ਕਿ ਕਬੱਡੀ ਖੋ ਖੋ ਵੋਲੀਬੋਲ ਫੁਟਬੋਲ ਆਦਿ ਗੇਮਾਂ ਨਹੀਂ ਖੇਲਦੇ ਹਨ ਕਿਉਂਕਿ ਵੱਜ ਵੱਧਦੀ ਹੋਈ ਟੈਕਨੋਲਜੀ ਦੇ ਨਾਲ਼ ਇਹ ਗੇਮ ਗੇਮਿੰਗ ਪੱਧਰ 'ਤੇ ਵੀ ਕਾਫ਼ੀ ਵਾਧਾ ਹੋਇਆ ਹੈ ਜਿਵੇਂ ਕਿ ਅੱਜ ਕੱਲ੍ਹ ਦੇ ਬੱਚੇ ਮੋਬਾਇਲ ਫ਼ੋਨ ਵਿੱਚ ਹੀ ਆਪਣਾ ਸਾਰਾ ਦਿਨ ਬਤੀਤ ਕਰ ਦਿੰਦੇ ਹਨ ਅਤੇ ਉਸ ਵਿੱਚ ਹੀ ਗੇਮਾਂ ਖੇਡਦੇ ਹਨ ਜਿਵੇਂ ਕਿ ਕਲੈਸ਼ ਆੱਫ ਕਲੈਨ ਪੱਬਜੀ ਬੀਜੀਐਮਆਈ ਫ੍ਰੀ ਫਾਇਰ ਆਦਿ ਗੇਮਾਂ ਜੋ ਕਿ ਡਿਜੀਟਲੀ ਖੇਲਦੇ ਹਨ ਅਤੇ ਕੋਈ ਵੀ ਫਿਜ਼ੀਕਲ ਐਕਟੀਵਿਟੀ ਨਹੀਂ ਕਰਦੇ ਹਨ